ਮੈਂ ਇੱਕ ਜੁਆਇੰਟ ਫੈਮਿਲੀ 'ਚ ਰਹਿੰਦੀ ਹਾਂ ਸਮੂਹ ਪਰਿਵਾਰ 'ਚ ਰਹਿੰਦੀ ਹਾਂ ਸਾਨੂੰ ਇਕੱਠੇ ਰਹਿਣਾ ਬਹੁਤ ਜ਼ਿਆਦਾ ਪਸੰਦ ਹੈ ਮੇਰੇ ਕੁਛ ਖਾਸ ਦੋਸਤ ਮਿੱਤਰ ਨਹੀਂ ਹੈਗੇ ਮੈਂ ਬਹੁਤ ਹੀ ਘੱਟ ਆਪਣੇ ਦੋਸਤ ਮਿੱਤਰ ਰੱਖੇ ਹਨ ਜਿਨ੍ਹਾਂ ਨਾਲ ਮੈਂ ਆਪਣਾ ਜੀਵਨ ਬਤੀਤ ਕਰਦੀ ਹਾਂ ਮੇਰੀ ਜ਼ਿੰਦਗੀ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਹੈ ਅਤੇ ਇਸ ਕਰਕੇ ਮੈਂ ਦੂਜਿਆਂ ਨੂੰ ਵੀ ਖੁਸ਼ਹਾਲ ਰਹਿਣ ਦਾ ਮੋਟੀਵੇਟ ਕਰਦੀ ਹਾਂ